ਸਤਿ ਸ਼੍ਰੀ ਅਕਾਲ ਮੇਰਾ ਨਾਮ ਅੰਸ਼ ਮਹਾਜਨ ਹੈ ਮੈਂ ਪਠਾਨਕੋਟ ਤੋਂ ਬੋਲ ਰਿਹਾ ਹਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਕੀ ਕੱਲ੍ਹ ਮੈਂ ਤੁਹਾਡੀ ਵੈੱਬਸਾਈਟ ਓਲਾ ਉਬਰ ਤੋਂ ਇਕ ਟੈਕਸੀ ਬੁੱਕ ਕੀਤੀ ਸੀ ਕਿਉਂਕਿ ਕੱਲ੍ਹ ਮੈਨੂੰ ਪਠਾਨਕੋਟ ਤੋਂ ਅੰਮ੍ਰਿਤਸਰ ਜ਼ਰੂਰੀ ਕੰਮ ਵਾਸਤੇ ਜਾਣਾ ਹੈ ਤਿੰਨ ਵਜੇ ਦੀ ਮੇਰੀ ਇੱਕ ਫਲਾਈਟ ਹੈ ਅਤੇ ਮੈਂ ਤੁਹਾਨੂੰ ਇਸ ਵਾਸਤੇ ਪੁੱਛਣਾ ਚਾਹੁੰਦਾ ਸੀ ਕਿ ਤੁਸੀਂ ਮੇਰੇ ਘਰ ਟਾਈਮ 'ਤੇ ਆ ਸਕਦੇ ਹੋ ਤਾਂ ਕਿ ਮੇਰੀ ਫਲਾਈਟ ਮਿਸ ਨਾ ਹੋਵੇ ਕਿ ਜੇਕਰ ਤੁਸੀਂ ਦਸ ਵਜੇ ਦੇ ਕਰੀਬ ਸ਼ਰੀਬ ਪਹੁੰ ਪਹੁੰਚ ਗਏ ਮੇਰੇ ਘਰ ਤਾਂ ਮੈਂ ਆਪਣੀ ਆਰਾਮ ਨਾਲ ਫਲਾਈਟ ਫੜ ਪਾਵਾਂਗਾ ਜੇ ਨਹੀਂ ਤਾਂ ਮੈਨੂੰ ਦੱਸ ਦਵੋ ਕਿਉਂਕਿ ਪਿਛਲੀ ਵਾਰ ਵੀ ਮੈਂ ਤੁਹਾਡੀ ਵੈਬਸਾਈਟ ਤੋਂ ਟੈਕਸੀ ਬੁੱਕ ਕੀਤੀ ਸੀ ਅਤੇ ਉਹ ਡਰਾਈਵਰ ਨੇ ਮੇਰਾ ਬੜਾ ਟਾਈਮ ਭੰਨਿਆ ਸੀ ਅਤੇ ਮੇਰਾ ਬਿਜਨਸ ਦਾ ਬਹੁਤ ਲੋਸ ਹੋਇਆ ਸੀ ਮੇਰੀ ਫਲਾਈਟ ਛੁੱਟ ਗਈ ਸੀ ਇਸ ਲਈ ਮੈਂ ਤੁਹਾਡੇ ਤੋਂ ਬੇਨਤੀ ਕਰਦਾ ਹਾਂ ਕਿ ਪਲੀਜ਼ ਤੁਸੀਂ ਮੈਨੂੰ ਦੱਸ ਦਵੋ ਕਿ ਕੱਲ੍ਹ ਤੁਸੀਂ ਟਾਈਮ 'ਤੇ ਆਵੋਗੇ ਜਾਂ ਨਹੀਂ ਜੇ ਨਹੀਂ ਆਉਣਾ ਚਾਹੁੰਦੇ ਤੁਸੀਂ ਤਾਂ ਮੈਨੂੰ ਦੱਸ ਦਵੋ ਮੈਂ ਆਪਣਾ ਹੋਰ ਕੋਈ ਇੰਤਜਾਮ ਵਗੈਰਾ ਕਰ ਲਵਾਂਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ